ਮੈਂ ਵਿਦੇਸ਼ ਜਾਣਾ ਚਾਹੁੰਦਾ ਹਾਂ ਵਿਦੇਸ਼ ਜਾਣ ਲਈ ਮੈਨੂੰ ਕਾਫੀ ਦਸਤਾਵੇਜ ਚਾਹੀਦੇ ਨੇ ਜਿਵੇਂ ਕੀ ਪੈਨ ਕਾਰਡ ਆਧਾਰ ਕਾਰਡ ਸੈਲਰ ਸਲਿਪ ਆਮਦਨ ਟੈਕਸ ਸਟੇਟਮੈਂਟ ਅਤੇ ਹੋਰ ਬਈ ਕਈ ਤਰ੍ਹਾਂ ਦੇ ਦਸਤਾਵੇਜ ਇਸ ਵਿੱਚ ਲਗਾਣੇ ਪੈਂਦੇ ਨੇ ਸਭ ਤੋਂ ਜ਼ਰੂਰੀ ਆਮਦਨ ਟੈਕਸ ਸਟੇਟਮੈਂਟ ਚਾਹੀਦੀ ਹੈ ਪੰਜ ਸਾਲਾਂ ਦੀ ਮੈਨੂੰ ਇਸ ਵਿੱਚ ਲਗਾਉਣ ਲਈ ਇਸ ਲਈ ਮੈਂ ਇਨਕਮ ਟੈਕਸ ਵਿਭਾਗ ਦੀ ਵੈਬਸਾਈਟ ਖੋਲ੍ਹੀ ਅਤੇ ਆਪਣਾ ਲੋਗਿਨ ਆਈਡੀ ਉੱਥੇ ਮੈਂ ਪਾਇਆ ਮੇਰਾ ਲੋਗਿਨ ਆਈਡੀ ਹੈ ਦੋ ਚਾਰ ਛੇ ਅੱਠ ਨੌਂ ਅਤੇ ਫੇਰ ਮੈਂ ਆਪਣਾ ਪਾਸਵਰਡ ਪਾਇਆ ਜੋ ਕੀ ਹੈ ਇੱਕ ਦੋ ਚਾਰ ਛੇ ਉਸ ਤੋਂ ਬਾਅਦ ਮੇਰੇ ਪੈਨ ਕਾਰਡ ਨਾਲ ਰਜਿਸਟਰ ਫੋਨ ਨੰਬਰ 'ਤੇ ਇੱਕ ਪਾਸਵਰਡ ਆਇਆ ਜਿਸ ਨੂੰ ਆਪਾਂ ਓਟੀਪੀ ਜਾਂ ਇੱਕ ਵਾਰ ਪਾਸਵਰਡ ਵੀ ਕਹਿੰਦੇ ਹਾਂ ਇਹ ਸਾਡੀ ਸੁਰੱਖਿਆ ਲਈ ਹੈ ਫਿਰ ਉਸ ਤੋਂ ਬਾਅਦ ਵੈਬਸਾਈਟ ਓਪਨ ਹੋ ਗਈ ਅਤੇ ਮੈਂ ਉੱਥੇ ਈ ਫਾਈਲ ਦਾ ਖਾਨਾ ਖੋਲਿਆ ਉਸ ਵਿੱਚ ਮੈਂ ਆਪਣਾ ਪੂਰਵਾ ਪੂਰਾ ਵੇਰਵਾ ਭਰਿਆ ਅਤੇ ਜਿਹੜੇ ਸਾਲ ਦੀ ਮੈਨੂੰ ਆਮਦਨ ਟੈਕਸ ਸਟੇਟਮੈਂਟ ਚਾਹੀਦੀ ਹੈ ਉਹਨਾਂ ਸਾਲਾਂ ਨੂੰ ਚੁਣਿਆ ਅਤੇ ਫਿਰ ਉੱਥੇ ਡਾਊਨਲੋਡ ਦੀ ਆਪਸ਼ਨ ਆਈ ਮੈਂ ਉਸ 'ਤੇ ਵੀ ਕਲਿੱਕ ਕਰ ਦਿੱਤਾ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਮੇਰੀ ਇਨਕਮ ਟੈਕਸ ਸਟੇਟਮੈਂਟ ਸਟੇਟਮੈਂਟ ਡਾਊਨਲੋਡ ਹੋ ਗਈ ਅਤੇ ਫਿਰ ਉਹਦੇ ਨੀਚੇ ਪ੍ਰਿੰਟ ਦਾ ਪ੍ਰਿੰਟ ਦਾ ਇੱਕ ਕੋਲਮ ਆਇਆ ਮੈਂ ਉੱਥੇ ਵੀ ਕਲਿੱਕ ਕਰ ਦਿੱਤਾ ਅਤੇ ਥੋੜ੍ਹੀ ਹੀ ਦੇਰ ਵਿੱਚ ਮੇਰੀ ਸਟੇਟਮੈਂਟ ਮੈਨੂੰ ਮਿਲ ਗਈ